ਹੈਲੋ ਤੁਸੀਂ ਤਾਜ ਹੋਟਲ ਤੋਂ ਬੋਲ ਰਹੇ ਹੋ ਮੈਂ ਐਕਚੁਲੀ ਕੁਛ ਟਾਈਮ ਪਹਿਲਾਂ ਡਿਨਰ ਔਡਰ ਕੀਤਾ ਸੀ ਅਤੇ ਜਿਹੜਾ ਤੁਹਾਡੀ ਡਿਲੀਵਰੀ ਹੈ ਉਹ ਪਹਿਲਾਂ ਹੀ ਪੰਦਰ੍ਹਾਂ ਮਿਨਟ ਲੇਟ ਆਈ ਹੈ ਅਤੇ ਹੁਣ ਮੈਂ ਜਦੋਂ ਪਾਰਸਲ ਡਿਲੀਵਰੀ ਵਾਲਾ ਓਪਨ ਕਰਕੇ ਦੇਖਿਆ ਤਾਂ ਜਿਹੜੀ ਛੇ ਸੱਤ ਰੋਟੀਆਂ ਮੰਗਵਾਈਆਂ ਸੀ ਉਹਦੇ ਅੰਦਰੋਂ ਤਿੰਨ ਤਾਂ ਬਿਲਕੁਲ ਹੀ ਬਾਸੀ ਲੱਗ ਰਹੀ ਹੈ ਅਤੇ ਜਿਹੜੀ ਦਾਲ ਨਾਲ ਮੰਗਵਾਈ ਸੀ ਉਹ ਵੀ ਮੈਨੂੰ ਠੀਕ ਨਹੀਂ ਲੱਗ ਰਹੀ ਉਹਦੇ 'ਚੋਂ ਵੀ ਐਵੇਂ ਲੱਗ ਰਿਹਾ ਵੀ ਜਿਵੇਂ ਸਮੈਲ ਆ ਰਹੀ ਆ ਜਾਂ ਖਰਾਬ ਹੋਈ ਹੁੰਦੀ ਹੈ ਅਤੇ ਉਹਦੇ ਨਾਲ ਪਨੀਰ ਮੰਗਵਾਇਆ ਸੀ ਪਨੀਰ ਮੈਨੂੰ ਫਿਰ ਥੋੜ੍ਹਾ ਠੀਕ ਲੱਗ ਰਿਹਾ ਪਰ ਜਿਹੜਾ ਰਾਇਤਾ ਏ ਉਹਨੂੰ ਦੇਖ ਕੇ ਐਵੇਂ ਲੱਗ ਰਿਹਾ ਵੀ ਜਿਵੇਂ ਖੱਟਾ ਹੈ ਅਤੇ ਤੁਹਾਡੀ ਸਰਵਿਸ ਮੈਨੂੰ ਇਸ ਵਾਰੀ ਬਿਲਕੁਲ ਵੀ ਅੱਛੀ ਨਹੀਂ ਲੱਗੀ ਰੋਟੀਆਂ ਬਾਸੀ ਹੋ ਗਈਆਂ ਸਬਜ਼ੀ ਠੀਕ ਨਹੀਂ ਹੈਗੀ ਅਤੇ ਜਿਹੜਾ ਮੈਂ ਸੈਲਡ ਮੰਗਵਾਇਆ ਸੀ ਉਹਦੇ ਅੰਦਰ ਵੀ ਸਾਰੇ ਸਬਜ਼ੀਆਂ ਨਹੀਂ ਹੈਗੀਆਂ ਉਹਦੇ ਅੰਦਰ ਤੁਸੀਂ ਸਿਰਫ ਪਿਆਜ਼ ਭੇਜਿਆ ਅਤੇ ਖੀਰਾ ਅਤੇ ਗਾਜਰ ਵੀ ਨਹੀਂ ਹੈਗਾ ਉਹਦੇ ਅੰਦਰ ਅਤੇ ਉਹ ਤੁਸੀਂ ਦੇਖ ਲਉ ਵੀ ਤੁਸੀਂ ਰੀਫੰਡ ਕਰੋਗੇ ਜਾਂ ਡਿਲੀਵਰੀ ਚੇਂਜ ਕਰੋਗੇ ਜਾਂ ਕਿਵੇਂ ਕਰੋਗੇ